ਸਮਾਜਿਕ ਅਤੇ ਨੈਤਿਕ ਮੁੱਦਿਆਂ 'ਤੇ ਇਸ ਧਰਮ ਦੀਆਂ ਸਿੱਖਿਆਵਾਂ ਆਪਣੇ ਹੱਕਾਂ ਲਈ ਲੜਨ ਲਈ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰ ਰਹੀ ਹਨ ਲੋਕਾਂ ਨੂੰ ਪਖੰਡਾਂ ਤੋਂ ਦੂਰ ਕਰ ਰਹੀਆਂ ਹਨ ਰਾਜਨੀਤੀਕ ਮਾਮਲਿਆਂ ਵਿੱਚ ਹੋ ਰਹੀ ਧੋਖਾਧੜੀ ਬਾਰੇ ਦੱਸ ਰਹੀਆਂ ਹਨ ਸੱਭਿਆਚਾਰ ਅਤੇ ਸਿੱਖ ਧਰਮ ਦੇ ਵਿਸ਼ਾਲ ਇਤਿਹਾਸ ਬਾਰੇ ਲੋਕਾਂ ਨੂੰ ਜਾਗਰੂਕ ਕਰ ਰਹੀਆਂ ਹਨ ਸ਼ਬਦ ਗੁਰੂ ਬਾਰੇ ਦੱਸ ਰਹੀਆਂ ਹਨ ਮਾਨਵਤਾ ਦੀ ਸੇਵਾ ਦਾ ਸੰਦੇਸ਼ ਦੇ ਰਹੀਆਂ ਹਨ ਸਭ ਤੋਂ ਵੱਡਾ ਧਰਮ ਇਨਸਾਨ ਨੂੰ ਇਨਸਾਨ ਦੇ ਕੰਮ ਆਉਣ ਦੇ ਯੋਗ ਬਣਾ ਰਹੀਆਂ ਹਨ ਜਿਸ ਨਾਲ ਮਨੁੱਖਾਂ ਦਾ ਜੀਵਨ ਧਰਮ ਦੇ ਲੇਖੇ ਲੱਗ ਕੇ ਇੱਕ ਚੰਗੇ ਇਨਸਾਨ ਬਣਨ ਵਿੱਚ ਮਦਦ ਕਰ ਰਿਹਾ ਹੈ